ਮੇਰੇ ਜੀਵਨ ਕਾਲ ਵਿੱਚ ਜੇਕਰ ਤਕਨਾਲੋਜੀ ਨੂੰ ਦੇਖਿਆ ਜਾਵੇ ਤਾਂ ਸਭ ਤੋਂ ਵੱਡੀ ਤਬਦੀਲੀ ਜੋ ਮੈਂ ਆਲ਼ੇ ਦੁਆਲ਼ੇ ਵਿੱਚ ਦੇਖਦਾ ਹਾਂ ਉਹ ਮੋਬਾਇਲ ਫੋਨ ਦੀ ਹੈ ਜਦੋਂ ਮੇਰਾ ਜਨਮ ਹੋਇਆ ਸੀ ਤਾਂ ਉਦੋਂ ਕੀਪੈਡ ਵਾਲੇ ਮੋਬਾਈਲ ਹੀ ਵਰਤ ਵਰਤੇ ਜਾਂਦੇ ਸਨ ਅਤੇ ਉਨ੍ਹਾਂ ਦਾ ਕੰਮ ਸਿਰਫ ਇੰਨਾ ਹੁੰਦਾ ਸੀ ਕਿ ਅਸੀਂ ਉਸ ਉੱਤੇ ਗੱਲਬਾਤ ਹੀ ਕਰਦੇ ਸੀ ਪ੍ਰੰਤੂ ਮੇਰੇ ਜਨਮ ਤੋਂ ਪੰਜ ਛੇ ਸਾਲ ਬਾਅਦ ਜੇ ਦੇਖਿਆ ਗਿਆ ਕਿ ਟੱਚ ਸਕਰੀਨਾਂ ਫ਼ੋਨਾਂ ਨੇ ਕੀਪੈਡ ਵਾਲੇ ਫੋਨਾਂ ਦੀ ਥਾਂ ਲੈ ਲਈ ਹੈ ਇਹਨਾਂ ਫੋਨਾਂ ਵਿੱਚ ਇੱਕ ਖਾਸ ਕਿਸਮ ਦਾ ਓਪਰੇਟਿੰਗ ਸਿਸਟਮ ਹੁੰਦਾ ਸੀ ਅਤੇ ਉਸ ਦੇ ਨਾਲ ਨਾਲ ਇੰਟਰਨੈੱਟ ਦੀ ਸੁਵਿਧਾ ਵੀ ਆਉਣ ਲੱਗੀ ਫੋਨ ਦੀ ਇਸ ਵਰਤੋਂ ਦੇ ਨਾਲ ਨਾਲ ਇਸਨੇ ਬਹੁਤ ਥਾਵਾਂ ਵਿੱਚ ਬਹੁਤ ਖੇਤਰਾਂ ਵਿੱਚ ਆਪਣਾ ਯੋਗਦਾਨ ਵੀ ਪਾਇਆ ਹੈ ਅਤੇ ਦੇਖਿਆ ਗਿਆ ਕਿ ਹਰੇਕ ਤਰੀਕੇ ਦੀ ਕੰਪਨੀ ਇੰਟਰਨੈੱਟ ਨਾਲ ਜੁੜੀ ਹੋਣ ਕਰਕੇ ਉਸਦੀ ਪਹੁੰਚ ਸਾਡੇ ਜੇਬ ਵਿੱਚ ਹੀ ਹੋ ਗਈ ਕਿਉਂਕਿ ਮੋਬਾਇਲ ਦੇ ਵਿੱਚ ਇੰਟਰਨੈੱਟ ਦੀ ਦੁਰਵਰਤੋਂ ਹੋਣ ਦੇ ਨਾਲ ਨਾਲ ਇਹ ਸਾਡੀ ਪਹੁੰਚ ਨੂੰ ਬਹੁਤ ਵਧਾ ਦਿੰਦਾ ਸੀ ਅਤੇ ਜੇਕਰ ਇਸ ਦੀਆਂ ਹਾਨੀਆਂ ਨੂੰ ਦੇਖਿਆ ਜਾਵੇ ਤਾਂ ਇਹ ਦੇਖਣ ਵਿੱਚ ਮਿਲਦਾ ਹੈ ਕਿ ਇੰਟਰਨੈੱਟ ਨੇ ਭਾਵੇਂ ਸਾਡੀ ਪਹੁੰਚ ਨੂੰ ਵਧਾਇਆ ਹੈ ਪਰੰਤੂ ਫਿਰ ਵੀ ਸਾਡੀ ਸਮੇਂ ਦੀ ਚੋਰੀ ਵੀ ਕਰਦਾ ਹੈ ਕਿਉਂਕਿ ਬੱਚੇ ਸਾਰਾ ਸਾਰਾ ਦਿਨ ਮੋਬਾਇਲ 'ਤੇ ਬੈਠੇ ਰਹਿੰਦੇ ਹਨ ਅਤੇ ਮਾਂ ਬਾਪ ਨੂੰ ਪੜ੍ਹਾਈ ਦਾ ਲਾਰਾ ਲਾ ਕੇ ਉਹ ਇੰਟਰਨੈੱਟ ਦੀ ਦੁਰਵਰਤੋਂ ਹੀ ਕਰਦੇ ਹਨ